ਪੰਜ ਹਜ਼ਾਰ ਚਾਰ ਸੌ ਤੀਹ ਦੋ ਹਜ਼ਾਰ ਪੰਜ ਸੌ ਪੰਜਾਹ ਪੰਜ ਹਜ਼ਾਰ ਤਿੰਨ ਸੌ ਤੇਰਾਂ ਛੇ ਲੱਖ ਚਾਲੀ ਹਜ਼ਾਰ ਛੇ ਸੌ ਪੰਦਰਾਂ ਪੰਜ ਲੱਖ ਸੱਠ ਹਜ਼ਾਰ ਨੌ ਸੌ ਪੱਚੀ